ਅੱਜ ਦੇ ਸੰਸਾਰ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਨੂੰ ਬੜੀਆਂ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਹਿਲਾਂ ਤਾਂ ਜਿਹੜੇ ਪੰ ਬੱਚੇ ਪੰਜਾਬੀ ਬੋਲਦੇ ਹਨ ਉਹਨਾਂ ਨੂੰ ਸਕੂਲਾਂ ਵਿੱਚ ਵੀ ਬਹੁਤ ਸਾਰੇ ਲੋਕ ਇਹ ਹੀ ਕਹਿੰਦੇ ਹਨ ਕਿ ਇਹ ਤਾਂ ਪੇਂਡੂ ਆ ਗਏ ਹਨ ਉਹ ਪੰਜਾਬੀ ਬੋਲਣ ਵਾਲੇ ਚੰਗੇ ਹੀ ਨਹੀਂ ਸਮਝਦੇ ਹਨ ਉਹ ਲੋਕ ਜਿਹੜੇ ਅਮੀਰ ਲੋਕ ਹੁੰਦੇ ਹਨ ਚਾਹੇ ਪੰਜਾਬ ਦੇ ਵਿੱਚ ਹੀ ਰਹਿੰਦੇ ਹਨ ਪਰ ਜਿਹੜੇ ਅਮੀਰ ਲੋਕ ਹੁੰਦੇ ਹਨ ਉਹਨਾਂ ਬੱਚਿਆਂ ਦੇ ਨਾਲ ਨਹੀਂ ਆਪਣੇ ਬੱਚੇ ਨੂੰ ਬਿਠਾਉਣਾ ਪਸੰਦ ਕਰਦੇ ਹਨ ਉਹ ਕਹਿੰਦੇ ਹਨ ਕਿ ਇਹ ਬੱਚਿਆਂ ਨੂੰ ਤਾਂ ਪੰਜਾਬੀ ਬੋਲਦਾ ਹੈ ਇਹ ਸਾਡੇ ਬੱਚਿਆਂ ਦੀ ਵੀ ਜਿਹੜੀ ਹੈ ਉਹ ਭਾਸ਼ਾ ਵਿਗਾੜ ਦੇਵੇਗਾ ਅੱਜ ਕੱਲ੍ਹ ਪੰਜਾਬ ਵਿੱਚ ਕੀ ਸੰਸਾਰ ਵਿੱਚ ਪੰਜਾਬੀ ਬੋਲਣ ਵਾਲੇ ਹੈਗੇ ਆ ਬੜੇ ਜਿਹੜੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹੋਰ ਹੋਰ ਵੱਖ ਵੱਖ ਦੇਸ਼ਾਂ ਦੇ ਵਿੱਚ ਵੀ ਗਏ ਹਨ ਜਿਵੇਂ ਕਨੇਡਾ ਆਸਟ੍ਰੇਲੀਆ ਇਹਨਾਂ ਵਿੱਚ ਪੰਜਾਬੀ ਵੀ ਗਏ ਹਨ ਉਹ ਪੰਜਾਬੀ ਉੱਥੇ ਜਾ ਕੇ ਬੋਲਦੇ ਹਨ ਅਤੇ ਸਾਰੇ ਲੋਕ ਉਹਨੂੰ ਕਹਿੰਦੇ ਹਨ ਤੇ ਇਹ ਤਾਂ ਪੇਂਡੂ ਜਿਹੇ ਹੀ ਆ ਗਏ ਹੈ ਅੱਜ ਕੱਲ੍ਹ ਪੰਜਾਬੀ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਲੋਕਾਂ ਨੂੰ ਤੇ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਵਿੱਚ ਵੀ ਪੰਜਾਬੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਬੱਚੇ ਬੋਲ ਪਾਉਂਦੇ ਹਨ ਕਿਉਂਕਿ ਜਿਹੜੇ ਆਮ ਜਿਹੜੇ ਦੂਸਰੇ ਸਕੂਲ ਹਨ ਵਧੀਆ ਸਕੂਲ ਹਨ ਉਹਨੂੰ ਪੰਜਾ ਉਹਨਾਂ ਨੇ ਪੰਜਾਬੀ ਭਾਸ਼ਾ ਲਗਾ ਤਾਂ ਦਿੱਤੀ ਹੋਈ ਹੈ ਪਰ ਉਹਨਾਂ ਨੂੰ ਜਿਹੜੇ ਬੱਚੇ ਪੰਜਾਬੀ ਬੋਲਦੇ ਹਨ ਤਾਂ ਉਹਨਾਂ ਨੂੰ ਬਹੁਤ ਗਵਾਰ ਬੱਚੇ ਸਮਝਿਆ ਜਾਂਦਾ ਹਨ ਉਹਨਾਂ ਨੂੰ ਇਹ ਚੰਗੇ ਬੱਚਿਆਂ ਦੇ ਗਿਣਤੀ ਵਿੱਚ ਜਿਹੜੇ ਬੱਚੇ ਜਿਹੜੇ ਇੰਗਲਿਸ਼ ਬੋਲਦੇ ਹਨ ਅੰਗਰੇਜ਼ੀ ਬੋਲਦੇ ਹਨ ਉਹਨਾਂ ਲੋਕਾਂ ਨੂੰ ਬੱਚਿਆਂ ਨੂੰ ਤਾਂ ਕਿਹਾ ਜਾਂਦਾ ਹੈ ਕਿ ਉਹ ਬੱਚੇ ਤਾਂ ਬਹੁਤ ਹੀ ਵਧੀਆ ਹਨ ਪਰ ਉਹਨਾਂ ਨੂੰ ਇਹ ਗੱਲ ਨਹੀਂ ਕਿ ਪੰਜਾਬ ਦੀ ਪੰਜਾਬੀ ਭਾਸ਼ਾ ਹੀ ਮਾਤਰ ਭਾਸ਼ਾ ਹੈ ਉਹਨਾਂ ਦੇ ਪੰਜਾਬ ਦੇ ਲੋਕਾਂ ਲਈ ਤਾਂ ਪੰਜਾਬੀ ਹੀ ਚੰਗੀ ਭਾਸ਼ਾ ਹੈ ਲੇਕਿਨ ਜਿਹੜੇ ਪੰਜਾਬ ਵਿੱਚ ਵੀ ਰਹਿੰਦੇ ਹਨ ਲੋਕ ਉਹ ਵੀ ਪੰਜਾਬੀ ਭਾਸ਼ਾ ਨੂੰ ਨਹੀਂ ਚੰਗਾ ਸਮਝਦੇ ਹਨ ਤੁਸੀਂ ਕਿਸੇ ਫੰਕਸ਼ਨਾਂ ਵਗੈਰਾ 'ਤੇ ਜਾਓ ਤੁਸੀਂ ਕਿਸੇ ਪਾਰਟੀਆਂ 'ਤੇ ਜਾਓ ਉੱਥੇ ਵੀ ਜਦੋਂ ਕੋਈ ਪ ਪੰਜਾਬੀ ਬੋਲਦਾ ਬੱਚਾ ਹੋਵੇਗਾ ਕਹੇਗਾ ਇਹ ਪਤਾ ਨਹੀਂ ਕਿਹੜੇ ਸਕੂਲ ਗੰਦੇ ਜਿਹੇ ਸਕੂਲ ਦੇ ਵਿੱਚ ਪੜ੍ਹ ਕੇ ਆਇਆ ਹੋਇਆ ਜਿਹੜਾ ਹੈ ਪੰਜਾਬੀ ਬੋਲਦਾ ਹੈ ਪਰ ਜਦੋਂ ਉਹ ਬੱਚਾ ਇੰਗਲਿਸ਼ ਕੋਈ ਬੋਲਦਾ ਹੈ ਦੂਸਰਾ ਬੱਚਾ ਤਾਂ ਕਹਿੰਦੇ ਆ ਬਹੁਤ ਚੰਗੇ ਸਕੂਲ ਦੇ ਵਿੱਚ ਪੜ੍ਹ ਕੇ ਆਉਂਦੇ ਚਾਹੇ ਦੋਨੋਂ ਬੱਚੇ ਇੱਕ ਹੀ ਸਕੂਲ ਦੇ ਵਿੱਚ ਪੜ੍ਹਦੇ ਹੋਏ ਹੋਣ ਪਰ ਉਹ ਬੱਚਿਆਂ ਨੂੰ ਅਲੱਗ ਵੱਖਰੀ ਨਿਗਾਹ ਨਾਲ ਦੇਖਿਆ ਜਾਂਦਾ ਹਨ ਉਹਨਾਂ ਲੋਕਾਂ ਨੂੰ ਉਸ ਕਰਕੇ ਪੰਜਾਬੀ ਬੋਲਣ ਵਾਲਿਆਂ ਨੂੰ ਬਹੁਤ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਜੇ ਕਿਸੇ ਮੌਲਾਂ ਦੇ ਵਿੱਚ ਜਾਂਦੇ ਹਨ ਬੱਚੇ ਜੋ ਉੱਥੇ ਵੀ ਪੰਜਾਬੀ ਬੋਲਣਗੇ ਅਤੇ ਫਿਰ ਉੱਥੇ ਸਾਰੇ ਲੋਕ ਉਹਨਾਂ ਵੱਲ ਦੇਖਦੇ ਹਨ ਆਹ ਦੇਖੋ ਬੱਚਾ ਕਿਹੋ ਜਿਹਾ ਜਿਹੜਾ ਪੰਜਾਬੀ ਬੋਲਦਾ ਪਿਆ ਹੈਨ ਇਸ ਕਰਕੇ ਸਾਨੂੰ ਬਹੁਤ ਸਾਰੀ ਚੁਣੌਤੀਆਂ ਦੇ ਵਿੱਚ ਸਾਨੂੰ ਸਾਹਮਣਾ ਕਰਨਾ ਪੈਂਦਾ